ਮੈਂ ਆਪਣੇ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਫ ਕਰਦੀ ਹਾਂ ਮੈਨੂੰ ਘਰ ਵਿੱਚ ਸਫਾਈ ਬਹੁਤ ਵਧੀਆ ਲੱਗਦੀ ਹੈ ਮੈਂ ਪਾਣੀ ਵਾਲਾ ਪਾਈਪ ਲੈ ਕੇ ਫਰਸ਼ ਧੋਂਦੀ ਹਾਂ ਘਰ ਦੀਆਂ ਕੰਧਾਂ ਉੱਪਰ ਵੀ ਮੈਂ ਪਾਣੀ ਛਿੜਕ ਦਿੰਦੀ ਹਾਂ ਪਾਇਪ ਨਾਲ ਪਾਣੀ ਮਾਰ ਦਿੰਦੀ ਹਾਂ ਪਾਣੀ ਦੇ ਨਾਲ ਨਾਲ ਮੈਂ ਫਰਸ਼ ਨੂੰ ਰੜਕੇ ਨਾਲ ਚੰਗੀ ਤਰ੍ਹਾਂ ਸਾਫ ਕਰਦੀ ਹਾਂ ਹਾਂਜੀ ਹੁਣ ਤਾਂ ਫਰਸ਼ ਅਤੇ ਪੱਕੇ ਘਰ ਹੋ ਗਏ ਹਨ ਪਹਿਲਾਂ ਸਾਡੇ ਮੰਮੀ ਜੀ ਦੱਸਦੇ ਸੀ ਕਿ ਅਸੀਂ ਕਿਸ ਤਰ੍ਹਾਂ ਗਊ ਡਕ ਦੀ ਵਰਤੋਂ ਕਰਦੇ ਸਨ ਮੈਨੂੰ ਉਹਨਾਂ ਨੇ ਦੱਸਿਆ ਕਿ ਪਹਿਲਾਂ ਕੱਚੇ ਘਰ ਹੁੰਦੇ ਸਨ ਉਹਨਾਂ ਨੂੰ ਗੋਹੇ ਗੋਹੇ ਅਤੇ ਮਿੱਟੀ ਵਿੱਚ ਰਲਾ ਕੇ ਕੰਧਾਂ ਨੂੰ ਲਿਪਿਆ ਜਾਂਦਾ ਸੀ ਅਤੇ ਹੇਠੋਂ ਵੀ ਕੱਚਾ ਹੁੰਦਾ ਸੀ ਉਸ ਉ ਉਸ ਉੱਪਰ ਉਸ ਉੱਪਰ ਬਹੁਤ ਵਧੀਆ ਵਧੀਆ ਉਸਨੂੰ ਬਹੁਤ ਵਧੀਆ ਤਰ੍ਹਾਂ ਲਿਪਿਆ ਜਾਂਦਾ ਸੀ ਉਹ ਬਹੁਤ ਹੀ ਰੀਝਾਂ ਨਾਲ ਲਿਪਦੇ ਸਨ ਫਿਰ ਉਸ ਕੰਧਾਂ ਉੱਪਰ ਪਾਂਡੂ ਵੀ ਫੇਰਦੇ ਸਨ ਉਹਨਾਂ ਉੱਪਰ ਫਿਰ ਕਲਾ ਕੀਤੀ ਜਾਂਦੀ ਸੀ ਉਹਨਾਂ ਚਿੱਤਰ ਬਣਾ ਕੇ ਕਲਰ ਕੀਤੇ ਜਾਂਦੇ ਸਨ ਅਤੇ ਉਹ ਬਹੁਤ ਸੋਹਣੇ ਲੱਗਦੇ ਸਨ ਅਤੇ ਇਹ ਹੱਥੀਂ ਕੀਤੀ ਕਲਾਕਾਰੀ ਹੁੰਦੀ ਹੈ ਅਤੇ ਇਹ ਸਿਹਤ ਲਈ ਵੀ ਲਾਭਦਾਇਕ ਹੁੰਦੀ ਹੈ ਇਸਦਾ ਨੁਕਸਾਨ ਕੋਈ ਨਹੀਂ ਹੁੰਦਾ ਜੇਕਰ ਕੱਚੇ ਵਿੱਚ ਕੋਈ ਪਾਣੀ ਜਾਂ ਚਾਹ ਵਗੈਰਾ ਕੁਛ ਹੋਰ ਡੁਲ੍ਹ ਜਾਵੇ ਤਾਂ ਕੋਈ ਗਿਰਨ ਦਾ ਖਤਰਾ ਨਹੀਂ ਹੁੰਦਾ ਅੱਜ ਕੱਲ੍ਹ ਫਰਸ਼ਾਂ ਉੱਪਰ ਫਿਰਨੈਲ ਦਾ ਪੋਚਾ ਲੱਗਦਾ ਹੈ ਪੱਕੇ ਘਰਾਂ ਵਿੱਚ ਫਿਰਨੈਲ ਦਾ ਪੋਚਾ ਲੱਗਦਾ ਹੈ ਅਤੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਫਰਸ਼ਾਂ ਉੱਪਰ ਡਿੱਗਣ ਦਾ ਵੀ ਖਤਰਾ ਰਹਿੰਦਾ ਹੈ